ਹੈਲੋ ਬਾਬਰ ਜੀ ਸਨੈਕਸ ਮੈਂ ਮਲਹੋਤਰਾ ਕਲੋਨੀ ਤੋਂ ਬੋਲ਼ ਰਹੀ ਹਾਂ ਇਕ ਘੰਟਾ ਪਹਿਲਾਂ ਮੈਂ ਭੋਜਨ ਆਰਡਰ ਕੀਤਾ ਸੀ ਜੋ ਕਿ ਦਾਲ ਮੱਖਣੀ ਸ਼ਾਹੀ ਪਨੀਰ ਅੱਠ ਬਟਰ ਨਾਨ ਅਤੇ ਵਨੀਲਾ ਆਈਸ ਕਰੀਮ ਹੈ ਮੇਰੇ ਘਰ ਮਹਿਮਾਨ ਆਉਣ ਵਾਲੇ ਹਨ ਅਤੇ ਮੈਨੂੰ ਜਲਦੀ ਤੋਂ ਜਲਦੀ ਇਸ ਦੀ ਜ਼ਰੂਰਤ ਹੈ ਕਿਰਪਾ ਕਰਕੇ ਪੁਸ਼ਟੀ ਕਰਕੇ ਮੈਨੂੰ ਇਹ ਦੱਸੋ ਕਿ ਇਹ ਆਰਡਰ ਕਦ ਤੱਕ ਮੇਰੇ ਘਰ ਪਹੁੰਚੇਗਾ ਅਤੇ ਜਲਦੀ ਤੋਂ ਜਲਦੀ ਪਹੁੰਚਾਉਣ ਹੀ ਕੋਸ਼ਿਸ਼ ਕਰੋ ਧੰਨਵਾਦ